ਹੈਲੋ ਤੁਸੀਂ ਹੰਗਰੀਜ਼ ਤੋਂ ਬੋਲ ਰਹੇ ਹੋ ਮੈਂ ਆਪਣੇ ਪਰਿਵਾਰ ਅਤੇ ਕੁਝ ਦੋਸਤਾਂ ਨਾਲ ਤੁਹਾਡੇ ਰੈਸਟੋਰੈਂਟ ਵਿੱਚ ਆਉਣਾ ਚਾਹੁੰਦਾ ਹਾਂ ਅਸੀਂ ਕੁੱਲ ਦਸ ਮੈਂਬਰ ਹੋਵਾਂਗੇ ਅ ਦਸ ਮੈਂਬਰਾਂ ਲਈ ਤੁਹਾਡੇ ਕੋਲ ਟੇਬਲ ਉਪਲੱਬਧ ਹਨ ਅਤੇ ਟੇਬਲ ਨੰਬਰ ਕਿੰਨਾ ਹੋਵੇਗਾ ਖਾਣੇ ਵਿੱਚ ਕੀ ਕੀ ਹੋਵੇਗਾ ਉਸ ਸਭ ਬਾਰੇ ਮੈਨੂੰ ਦੱਸੋ ਅਤੇ ਤੁਹਾਡੀ ਕਾਰ ਪਾਰਕਿੰਗ ਦੀ ਸਮਾਂ ਕਦੋਂ ਹੈ ਅਤੇ ਤੁਹਾਡੇ ਰੈਸਟੋਰੈਂਟ ਦੇ ਬੰਦ ਹੋਣ ਦਾ ਸਮਾਂ ਕਦੋਂ ਤੱਕ ਹੈ